ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਰੋਹਿਤ ਕੁਮਾਰ ਬੋਲ ਰਿਹਾ ਅਤੇ ਮੈਂ ਨਾ ਕੱਲ੍ਹ ਤੁਹਾਡੀ ਕੈਬ ਦੇ ਵਿੱਚ ਗਿਆ ਸੀਗਾ ਅੰਬਰਸਰ ਤੋਂ ਲੁਧਿਆਣਾ ਅਤੇ ਉਸ ਵਿੱਚ ਨਾ ਮੇਰਾ ਫੋਨ ਰਹਿ ਗਿਆ ਸੀਗਾ ਅਤੇ ਉਹ ਮੈਂ ਤੁਹਾਨੂੰ ਤੁਹਾਡੇ ਉਭਰ ਦੇ ਕਸਟਮਰ ਕੇਅਰ ਸੈਂਟਰ ਤੋਂ ਤੁਹਾਡਾ ਨੰਬਰ ਲਿਆ ਸੀਗਾ ਅਤੇ ਪਲੀਜ਼ ਰਿਕੁਐਸਟ ਵਾਲੀ ਗੱਲ ਹੈ ਜੇ ਤੁਹਾਨੂੰ ਉਹ ਫੋਨ ਮਿਲਿਆ ਜਾਂ ਕਿਸੇ ਨੇ ਤੁਹਾਡੀ ਉਬਰ ਦੇ ਵਿੱਚੋਂ ਲਿਆ ਹੈ ਅਤੇ ਪਲੀਜ਼ ਜੇ ਕੈਬ ਦੇ ਵਿੱਚੋਂ ਵੀ ਕਿਸੇ ਨੇ ਚੱਕਿਆ ਤਾਂ ਪਲੀਜ਼ ਮੈਨੂੰ ਉਹ ਦੇ ਦਿਓ ਅਤੇ ਕਿੱਦਾਂ ਮਿਲ ਸਕਦਾ ਮੈਨੂੰ ਦੱਸ ਦਿਓ ਕਿੱਥੇ ਜਿੱਥੇ ਤੁਸੀਂ ਕਹੋਗੇ ਉੱਥੇ ਮੈਂ ਆਉਣ ਨੂੰ ਤਿਆਰ ਹਾਂ ਬਾਕੀ ਤੁਹਾਨੂੰ ਜੋ ਬਣਦਾ ਤੁਹਾਡਾ ਖੁਸ਼ੀ ਨਾਲ ਮੈਂ ਤੁਹਾਨੂੰ ਜੋ ਵੀ ਤੁਸੀਂ ਕਹੋਗੇ ਦੇਣ ਨੂੰ ਤਿਆਰ ਹਾਂ ਪਰ ਉਹਦੇ ਵਿੱਚ ਮੇਰੇ ਬਹੁਤ ਜ਼ਰੂਰੀ ਡਾਕੂਮੈਂਟ ਨੇ ਕਿਰਪਾ ਕਰਕੇ ਮੈਨੂੰ ਦਿੱਤਾ ਜਾਵੇ ਬਾਕੀ ਤੁਸੀਂ ਜੇ ਕਹੋਗੇ ਤਾਂ ਮੈਂ ਲੁਧਿਆਣੇ ਆਉਣ ਨੂੰ ਵੀ ਤਿਆਰ ਹਾਂ ਜੇ ਅੰਬਰਸਰ ਕਹੋਗੇ ਮੈਂ ਅੰਬਰਸਰੋਂ ਲੈਣ ਨੂੰ ਵੀ ਤਿਆਰ ਹਾਂ ਤੁਸੀਂ ਜਿੱਦਾਂ ਕਹੋਗੇ ਉੱਦਾਂ ਮੈਂ ਕਰਨ ਨੂੰ ਤਿਆਰ ਹਾਂ ਰਿਕੁਐਸਟ ਵਾਲੀ ਗੱਲ ਹੈ ਬਾਕੀ ਮੇਰਾ ਨੰਬਰ ਤੁਹਾਡੇ ਕੋਲ ਹੈਗਾ ਆ ਮੈਂ ਤੁਹਾਡੀ ਔਨਲਾਈਨ ਬੁਕਿੰਗ ਕੀਤੀ ਸੀਗੀ ਬਾਈ ਮਾਰਚ ਨੂੰ ਅਤੇ ਉਸ ਤੋਂ ਬਾਅਦ ਬਾਈ ਮਾਰਚ ਨੂੰ ਰਾਤ ਨੂੰ ਮੈਂ ਤੁਹਾਡੀ ਗੱਡੀ 'ਚ ਬੈਠਾ ਸੀਗਾ ਰਾਤ ਦੀ ਸ਼ਿਫਟ ਸੀਗੀ ਤੁਹਾਡੀ ਤੁਸੀਂ ਮੈਨੂੰ ਲੁਧਿਆਣੇ ਛੱਡ ਕੇ ਆਏ ਸੀਗੇ ਅਤੇ ਦੇਖ ਲਓ ਤੁਸੀਂ ਅਤੇ ਜੇ ਤੁਸੀਂ ਕਹਿੰਦੇ ਹੋ ਅਤੇ ਮੈਂ ਤੁਹਾਡੇ ਔਫਿਸ ਵੀ ਆ ਸਕਦਾ ਤੁਸੀਂ ਆਪਣਾ ਆਫਿਸ ਦਾ ਐਡਰੈਸ ਮੈਨੂੰ ਸੈਂਡ ਕਰ ਦਿਓ ਅਤੇ ਮੈਂ ਉੱਥੇ ਤੁਹਾਨੂੰ ਆ ਕੇ ਤੁਹਾਨੂੰ ਮਿਲ ਲਵਾਂਗਾ ਮਿਹਰਬਾਨੀ ਜੀ